ਬੰਸੀ ਦੇ ਢਾਬੇ ਤੋਂ ਬੋਲਦੇ ਹੋ ਮੈਂ ਤੁਹਾਨੂੰ ਆਰਡਰ ਬੁੱਕ ਕੀਤਾ ਸੀ ਮੈਂ ਆਪਣੇ ਮੇਰੇ ਘਰੇ ਪਾਰਟੀ ਸੀ ਦਸ ਪੰਦਰਾਂ ਜਨੇ ਆਏ ਸੀ ਉਹਨਾਂ ਵਾਸਤੇ ਖਾਣਾ ਆਰਡਰ ਕੀਤਾ ਸੀ ਤੁਸੀਂ ਨੋ ਵੈੱਜ ਖਾਣਾ ਭੇਜਣਾ ਸੀ ਨੋਨ ਵੈੱਜ ਭੇਜ ਤਾ ਮੇਰੀ ਇਨੀ ਬੇਇਜ਼ਤੀ ਫੀਲ ਹੋਈ ਮੈਨੂੰ ਇਨਾ ਗੁੱਸਾ ਚੜਿਆ ਤੁਹਾਡੇ ਤੇ ਤੁਹਾਨੂੰ ਵੈੱਜ ਖਾਣਾ ਆਰਡਰ ਕੀਤਾ ਸੀ ਤੁਸੀਂ ਨੋਨ ਵੈੱਜ ਭੇਜ ਤਾ ਹੁਣ ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਖਾਣਾ ਆਰਡਰ ਨਹੀਂ ਕਰੂੰਗੀ ਮੈਂ ਖੁਦ ਪੰਦਰਾ ਜਣਿਆਂ ਦਾ ਖਾਣਾ ਘਰੇ ਬਣਾਇਆ ਠੀਕ ਐ ਹੁਣ ਦੱਸੋ ਮੈਂ ਕੀ ਆਰਡਰ ਕਰਾਉਂਗੀ ਜਾਂ ਹੋਰ ਕਿਸੇ ਨੂੰ ਦੱਸੂਗੀ ਕਿਸੇ ਤੁਹਾਡੇ ਬਾਰੇ ਵੀ ਤੁਹਾਡੇ ਤੋਂ ਖਾਣਾ ਮੰਗਵਾਵੇ ਅੱਜ ਤੋਂ ਬਾਅਦ ਮੈਂ ਤੁਹਾਡੇ ਤੋਂ ਖਾਣਾ ਨਹੀਂ ਮੰਗਵਾਉਂਗੀ ਤੇ ਨਾ ਹੀ ਕਿਸੇ ਨੂੰ ਕਹੂੰਗੀ ਵੀ ਤੁਹਾਡੇ ਤੋਂ ਖਾਣਾ ਮੰਗਾਵੇ ਬਸ ਹੁਣ ਤੁਹਾਡਾ ਹੋਟਲ ਕੀ ਚੱਲੂਗਾ